ਹੈਲੋ ਸਤਿ ਸ਼੍ਰੀ ਅਕਾਲ ਮੈਮ ਹਾਂ ਮੈਮ ਮੈਨੂੰ ਸਤਵਿੰਦਰ ਨੇ ਤੁਹਾਡਾ ਨੰਬਰ ਦਿੱਤਾ ਸੀਗਾ ਠੀਕ ਹੈ ਮੈਮ ਹੋਰ ਠੀਕ ਠਾਕ ਹੋ ਹਾਂਜੀ ਮੈਂ ਰੁਪਿੰਦਰ ਗੱਲ ਕਰਦੀ ਹਾਂ ਮੈਮ ਹਾਂ ਵਧੀਆ ਵਧੀਆ ਮੈਮ ਐਕਚੁਲੀ ਨਾ ਮੇਰੀ ਬੰਗਲੌਰ ਤੋਂ ਇੱਥੇ ਬਠਿੰਡਾ ਟਰਾਂਸਫਰ ਹੋਈ ਹੈਗੀ ਅਤੇ ਇੱਥੇ ਜਿਹੜਾ ਨਾ ਅਸੀਂ ਮਤਲਬ ਬਠਿੰਡੇ ਦੇ ਪਾਣੀ ਬਾਰੇ ਕਾਫੀ ਕੁਛ ਸੁਣਿਆ ਹੈ ਵੀ ਪਾਣੀ ਨਹੀਂ ਵਧੀਆ ਇਹਦੇ ਨਾਲ ਕਾਫੀ ਬਿਮਾਰੀਆਂ ਹੋ ਜਾਂਦੀਆਂ ਅਤੇ ਉਹ ਮੈਂ ਤਾਂ ਥੋੜ੍ਹੀ ਤੁਹਾਡੇ ਤੋਂ ਜਾਣਕਾਰੀ ਲੈਣਾ ਚਾਹੁੰਦੀ ਸੀ ਵੀ ਕਿਹੜੇ ਏਰੀਏ 'ਚ ਪਾਣੀ ਵਧੀਆ ਹੈਗਾ ਵੀ ਫਿਰ ਉੱਥੇ ਹੀ ਜਗ੍ਹਾ ਲਈ ਜਾਵੇ ਉਸ ਹਿਸਾਬ ਨਾਲ ਅੱਛਾ

ਹਾਂਜੀ ਹਾਂ ਠੀਕ ਹੈ ਮੈਮ ਠੀਕ ਹੈ ਠੀਕ ਹੈ ਮਤਲਬ ਵਧੀਆ ਪੀਣ ਵਾਲਾ ਪਾਣੀ ਇੱਧਰੋਂ ਸਹੀ ਹੈਗਾ ਅੱਛਾ ਠੀਕ ਹੈ ਠੀਕ ਹੈ ਹੋਰ ਵੈਸੇ ਤਾਂ ਘਰ ਬਸ ਘੜੇ ਵਾਲਾ ਪਾਣੀ ਮਤਲਬ ਫਰਿੱਜ ਫਰੁੱਜ ਦਾ ਵੀ ਨਹੀਂ ਯੂਜ਼ ਕਰਦੇ ਘੜੇ ਦਾ ਹੀ ਜ਼ਿਆਦਾ ਯੂਜ਼ ਕਰਦੇ ਹੈਗੇ ਹਾਂ ਬੱਚਿਆਂ ਨੂੰ ਵੀ ਦਿੰਦੇ ਨਹੀਂ ਜ਼ਿਆਦਾ ਠੰਡਾ ਪਾਣੀ ਪਰ ਆਈ ਸੀ ਬੀ ਆਈ ਅਸੀਂ ਹਾਂ ਉਹੀ ਹੈ ਨਾ ਉਹ ਬਸ ਆਉਣ ਤੋਂ ਪਹਿਲਾਂ ਬਠਿੰਡੇ ਏਰੀਏ ਬਾਰੇ ਕਾਫੀ ਸੁਣਿਆ ਸੀ ਵੀ ਕਹਿੰਦੇ ਇੱਥੇ ਪਾਣੀ ਨਹੀਂ ਵਧੀਆ ਪੀਣ ਵਾਲਾ ਐਵੇਂ ਐਵੇਂ ਆ ਤਾਂ ਫਿਰ ਫਿਰ ਫਿਰ ਨੋਨ ਨਾਲ ਗੱਲ ਕੀਤੀ ਉਨ੍ਹਾਂ ਨੇ ਫਿਰ ਤੁਹਾਡਾ ਨੰਬਰ ਦਿੱਤਾ ਸੀ ਠੀਕ ਹੈ ਠੀਕ ਹੈ ਮੈਮ ਹੋਰ ਠੀਕ ਹੈ ਮੈਮ ਓ ਓਕੇ ਮੈਮ ਥੈਂਕਯੂ ਠੇਕ ਹੈ ਜੀ ਓਕੇ